ਹਾਂਜੀ ਮੇਰਾ ਮਨਪਸੰਦ ਕਲਾਕਾਰ ਸਿੱਧੂ ਮੂਸੇਵਾਲਾ ਹੈ ਜੋ ਕਿ ਇੱਕ ਪ੍ਰਸਿੱਧ ਗਾਇਕ ਸੀ ਅਤੇ ਉਹ ਪੂਰੇ ਸੰਸਾਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ ਇੱਕ ਵਾਰ ਤਾਂ ਮੈਂ ਉਸ ਨੂੰ ਉਦੋਂ ਸ਼ੋਅ ਦੌਰਾਨ ਮਿਲਿਆ ਸੀ ਉਹ ਮੇਰੇ ਨਾਲ ਬਹੁਤ ਨਿਮਰਤਾ ਨਾਲ ਪੇਸ਼ ਹੋਇਆ ਉਨ੍ਹਾਂ ਨੇ ਮੈਨੂੰ ਗਰੀਬਾਂ ਦੀ ਮਦਦ ਕਰਨ ਲਈ ਚੈੱਕ ਦਿੱਤਾ ਸੀ ਅਤੇ ਮੈਨੂੰ ਗਰੀਬਾਂ ਦੀ ਲੋੜ ਲੋੜਵੰਦ ਸੇਵਾ ਕਰਨ ਦੀ ਬਹੁਤ ਚੰਗੀ ਸਹਿ ਸਲਾਹ ਵੀ ਦਿੱਤੀ ਅਤੇ ਸਿੱਧੂ ਮੂਸੇਵਾਲਾ ਬਹੁਤ ਹੀ ਵਧੀਆ ਸਿੰਗਰ ਸੀ